ਬੂਟ ਜਮ੍ਹਾ ਹੀ ਬੇਕਾਰ ਸੀ ਉਹ ਲੈਂਦੇ ਸਾਰ ਹੀ ਜਦੋਂ ਮੈਂ ਤਿੰਨ ਚਾਰ ਦਿਨ ਪਾਏ ਉਹ ਉਹਨਾਂ ਨੀਚੇ ਸੋਲ ਹੁੰਦੀ ਜਿਹੜੀ ਉਹ ਟੁੱਟ ਕੇ ਝੜ ਗਈ